ਸਤਿ ਸ਼੍ਰੀ ਅਕਾਲ ਜੀ ਅਸੀਂ ਮੈਂ ਆਪਣੇ ਮੋਬਾਈਲ ਦੇ ਉੱਤੇ ਨਿਊਜ਼ ਫੀਡ ਕਰ ਨਿਊਜ਼ ਪੜ੍ਹਦੇ ਹਾਂ ਸੁਣਦੇ ਹਾਂ ਸਭ ਕੁਝ ਕਰਦੇ ਹਾਂ ਅਸੀਂ ਪੰਜਾਬੀ ਜਗਬਾਣੀ ਚੈਨਲ ਤੋਂ ਪੰਜਾਬ ਟੂਡੇ ਚੈਨਲ ਤੋਂ ਅਤੇ ਅਸੀਂ ਹੋਰ ਕਈ ਤਰ੍ਹਾਂ ਦੇ ਚੈਨਲਾਂ ਤੋਂ ਫੋਨ 'ਤੇ ਨਿਊਜ਼ਾਂ ਫੀਡ ਕਰਦੇ ਹਾਂ ਪੜ੍ਹਦੇ ਹਾਂ ਅਤੇ ਜਿਵੇਂ ਕਿ ਸਾਨੂੰ ਮੋਬਾਈਲ ਵਿੱਚ ਬਹੁਤ ਤਰ੍ਹਾਂ ਦੀਆਂ ਨਿਊਜ਼ ਮਿਲਦੀਆਂ ਹਨ ਅਤੇ ਫੋਨ 'ਤੇ ਅਦਰਵਾਈਜ਼ ਅਸੀਂ ਬਾਹਰ ਕਿੱਧਰੇ ਹੁੰਦੇ ਹਾਂ ਤਾਂ ਪੰਜਾਬ ਫੋਨ ਦੇ ਵਿੱਚ ਵੀ ਨਿਊਜ਼ ਨੂੰ ਪੜ੍ਹ ਸਕਦੇ ਹਾਂ ਇਸ ਕਰਕੇ ਅਸੀਂ ਫੋਨ ਦੇ ਵਿੱਚ ਬਹੁਤ ਜ਼ਿਆਦਾ ਨਿਊਜ਼ਾਂ ਪੜ੍ਹਦੇ ਹਾਂ ਵੇ ਇਸ ਦੇ ਚੈਨਲ ਵੀ ਬਹੁਤ ਤਰ੍ਹਾਂ ਦੇ ਆਉਂਦੇ ਨੇ ਜਿਵੇਂ ਕਿ ਟੂਡੇ ਚੈਨਲ ਹੋ ਗਿਆ ਰਾਜਾ ਚੈਨਲ ਹੋ ਗਿਆ ਜਗਬਾਣੀ ਚੈਨਲ ਹੋ ਗਿਆ ਪੀ ਟੀ ਸੀ ਚੈਨਲ ਹੋ ਗਿਆ ਅਤੇ ਪੰਜਾਬ ਚੈ ਪੰਜਾਬ ਚੈਨਲ ਹੋ ਗਿਆ ਬਹੁਤ ਤਰ੍ਹਾਂ ਦੇ ਪੰਜਾਬੀ ਚੈਨਲ ਹਨ ਜੋ ਅਸੀਂ ਆਪਣੇ ਫੋਨ ਦੇ ਉੱਤੇ ਉਹਨਾਂ ਨੂੰ ਦੇ ਉਹਨਾਂ ਦੇ ਉੱਤੇ ਨਿਊਜ਼ਾਂ ਪੜ੍ਹ ਵੀ ਸਕਦੇ ਹਾਂ ਇਸ ਅਤੇ ਅਸੀਂ ਸੁਣ ਵੀ ਸਕਦੇ ਹਾਂ ਅਤੇ ਬਹੁਤ ਤਰ੍ਹਾਂ ਦੇ ਚੈਨਲ ਆਉਂਦੇ ਨੇ ਜੋ ਸਾਨੂੰ ਆਪਣੀ ਦੁਨੀਆ ਭਰ ਦੇ ਆ ਸਾਰੇ ਪੰਜਾਬ ਦੇ ਸਾਰੇ ਬਾਰੇ ਸਾਨੂੰ ਨੌਲਜ ਨੌਲੇਜ ਦਿੰਦੇ ਨੇ ਪੰਜਾਬੀ ਖ਼ਬਰਾਂ ਸੁਣਾਉਂਦੇ ਨੇ ਅਸੀਂ ਉਹਨਾਂ 'ਚੋਂ ਬਹੁਤ ਤਰ੍ਹਾਂ ਦੀਆਂ ਜਾਣਕਾਰੀਆਂ ਵੀ ਲੈ ਸਕਦੇ ਹਾਂ ਪੰਜਾਬੀ ਨਿਊਜ਼ ਤੋਂ ਅਸੀਂ ਘ ਘਰ ਬੈਠੇ ਹੀ ਆਪਣੇ ਫੋਨ 'ਤੇ ਬਹੁਤ ਤਰ੍ਹਾਂ ਦੀਆਂ ਨਿਊਜ਼ਾਂ ਸੁਣ ਸਕਦੇ ਹਾਂ ਪੜ੍ਹ ਵੀ ਸਕਦੇ ਹਾਂ ਜੇ ਆਪਾਂ ਪੜ੍ਹੇ ਲਿਖੇ ਹਾਂ ਤਾਂ ਅਸੀਂ ਉਹਨਾਂ ਨੂੰ ਪੜ੍ਹ ਵੀ ਸਕਦੇ ਹਾਂ ਅਤੇ ਸੁਣ ਵੀ ਸਕਦੇ ਹਾਂ ਪੰਜਾਬ ਫੋਨ ਦੇ ਵਿੱਚ ਬਹੁਤ ਤਰ੍ਹਾਂ ਦੇ ਵਿੱਚ ਹੋਰ ਵੀ ਬਹੁਤ ਤਰ੍ਹਾਂ ਦੇ ਚੈਨਲ ਆਉਂਦੇ ਨੇ ਜਿਹਨਾਂ ਦੇ ਉੱਤੇ ਆਪਾਂ ਅਸੀਂ ਖ਼ਬਰਾਂ ਸੁਣ ਵੀ ਸਕਦੇ ਹਾਂ ਪੜ੍ਹ ਵੀ ਸਕਦੇ ਹਾਂ ਪਰ ਜੋ ਆਪਾਂ ਨੂੰ ਚੰਗਾ ਲੱਗਦਾ ਚੈਨਲ ਉਹ ਆਪਾਂ ਉਸ ਨੂੰ ਹੀ ਸੁਣਦੇ ਹਾਂ